ਹਾਂਜੀ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਨੂੰ ਇਤਿਹਾਸ ਪੜ੍ਹਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਆਪਣੇ ਸੱਭਿਆਚਾਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਸਾਡੇ ਇਤਿਹਾਸ ਵਿੱਚ ਕੀ ਕੀ ਹੋਇਆ ਹੋਇਆ ਹੈ ਔਰ ਕਿਸ ਕਾਰਨ ਅਸੀਂ ਇੱਥੇ ਪ੍ਰੈਜੈਂਟ ਹਾਂ ਕਿਸ ਤਰ੍ਹਾਂ ਸਾਡੇ ਲਈ ਸਾਡੇ ਮਤਲਬ ਕਿ ਸਾਡੇ ਗੁਰੂਆਂ ਨੇ ਸਾਡੇ ਇੱਧਰ ਗੋਲਡਨ ਟੈਂਪਲ ਬਣਾਏ ਕੋਈ ਕਿਸੇ ਨੇ ਸਾਡੇ ਇੱਧਰ ਕੋਈ ਸਰੋਵਰ ਬਣਾਇਆ ਇਹ ਸਾਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿ ਲੋਕ ਔਰ ਬੱਚੇ ਇਸਨੂੰ ਜਾਣ ਸਕਣ ਔਰ ਮੈਂ ਇਹ ਦੱਸਣਾ ਚਾਹਾਂਗੀ ਕਿ ਮੈਂ ਇਤਿਹਾਸ ਦੀਆਂ ਕਹਾਣੀਆਂ ਬੱਚਿਆਂ ਨੂੰ ਵੀ ਸੁਣਾਉਂਦੀ ਹਾਂ ਤਾਂ ਕਿ ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿ ਸਾਡੇ ਇਤਿਹਾਸ ਵਿੱਚ ਕੀ ਕੀ ਹੋ ਰਿਹਾ ਸੀ ਕੀ ਹੋਇਆ ਸੀ ਕਿੱਦਾਂ ਸਾਡੇ ਪੰਜਾਬ ਦੇ ਮਤਲਬ ਕਿ ਟੁਕੜੇ ਹੋਏ ਕਿੱਦਾਂ ਸਾਡੇ ਇਤਿਹਾਸ ਵਿੱਚ ਨਾਈਨਟੀ ਨਾਈਨਟੀ ਨਾਈਨ ਵਿੱਚ ਸਾਡੇ ਪੰਜਾਬ ਵਿੱਚ ਗੁਰੂ ਅੰਮ੍ਰਿਤਸਰ ਜੋ ਕਿ ਗੋਲਡਨ ਟੈਪਲ ਵਿੱਚ ਕਿੱਦਾਂ ਉਹਨਾਂ ਨੇ ਸਾਡੇ ਜਨਾਨੀਆਂ ਨੂੰ ਰਿਹਾਅ ਕੀਤਾ ਸੀ ਇੰਦਰਾ ਗਾਂਧੀ ਦੀ ਸਰਕਾਰ ਨੇ ਔਰ ਕਿਸ ਤਰ੍ਹਾਂ ਸਾਡੇ ਜ ਲੋਕਾਂ ਨੂੰ ਮਾਰਿਆ ਸੀ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਵਿੱਚ ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਨੂੰ ਹਮੇਸ਼ਾ ਇਹ ਪਤਾ ਲੱਗਦਾ ਰਹੇ ਕਿ ਸਾਡੇ ਇਤਿਹਾਸ ਵਿੱਚ ਕੀ ਕੀ ਹੋਇਆ ਹੈ ਔਰ ਮੈਂ ਆਪਣੇ ਘਰ ਵਿੱਚ ਆਉਂਦੇ ਟਿਊਸ਼ਨ ਵਾਲੇ ਬੱਚਿਆਂ ਨੂੰ ਇਹ ਸਾਰੇ ਇਤਿਹਾਸਿਕ ਚੀਜ਼ਾਂ ਬਾਰੇ ਜਾਣਕਾਰੀ ਅਵੱਸ਼ ਦਿੰਦੀ ਹਾਂ